ਸਤਿ ਸ਼੍ਰੀ ਅਕਾਲ ਜੀ ਕੁਝ ਸਮਾਂ ਪਹਿਲਾਂ ਮੈਂ ਵਿਦੇਸ਼ ਘੁੰਮਣ ਗਈ ਸੀ ਅਸੀਂ ਭੂਟਾਨ ਦੀ ਯਾਤਰਾ ਕਰਕੇ ਆਏ ਹਾਂ ਅਸੀਂ ਉੱਥੇ ਬਹੁਤ ਹੀ ਵਧੀਆ ਥਾਵਾਂ ਦੇਖੀਆਂ ਅਸੀਂ ਉੱਥੇ ਰਾਈਡ ਸ਼ੇਅਰਿੰਗ ਸੇਵਾ ਦੀ ਵਰਤੋਂ ਕੀਤੀ ਅਸੀਂ ਵੀ ਦੋ ਮੈਂਬਰ ਸੀ ਅਤੇ ਉਹ ਵੀ ਦੋ ਮੈਂਬਰ ਸਨ ਉਹਨਾਂ ਦੇ ਨਾਲ ਸਾਡਾ ਸਮਾਂ ਬਹੁਤ ਹੀ ਵਧੀਆ ਨਿਕਲਿਆ ਅਤੇ ਸਾਡਾ ਇਹ ਅਨੁਭਵ ਬਹੁਤ ਹੀ ਵਧੀਆ ਰਿਹਾ ਇਸ ਦਾ ਇੱਕ ਫ਼ਾਇਦਾ ਤਾਂ ਇਹ ਹੁੰਦਾ ਹੈ ਕਿ ਰਾਈਡ ਸ਼ੇਅਰ ਕਰਨ ਦੇ ਨਾਲ ਸਾਡਾ ਕਿਰਾਇਆ ਵੀ ਘੱਟ ਲੱਗਦਾ ਹੈ ਅਤੇ ਸਾਡਾ ਸਮਾਂ ਵੀ ਵਧੀਆ ਨਿਕਲ ਜਾਂਦਾ ਹੈ ਕਿਉਂਕਿ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕਈ ਵਾਰ ਅਸੀਂ ਥੋੜ੍ਹਾ ਡਰਦੇ ਹਾਂ ਜਾਂ ਫਿਰ ਬੋਰੀਅਤ ਮਹਿਸੂਸ ਕਰਦੇ ਹਾਂ ਜੇਕਰ ਅਸੀਂ ਕਿਸੇ ਦੀ ਕੰਪਨੀ ਜੁਆਇਨ ਕਰੀਏ ਤਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਅਤੇ ਦੂਸਰਿਆਂ ਦੇ ਨਾਲ ਸਮਾਂ ਬਿਤਾ ਕੇ ਸਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਵੀ ਸਿੱਖਣ ਨੂੰ ਮਿਲਦੀਆਂ ਹਨ ਧੰਨਵਾਦ ਜੀ